ਪੇਂਡੂ ਇਲਾਕਿਆਂ ਦੇ ਵਿੱਚ ਖੇਤੀਬਾੜੀ ਦਾ ਸੁਧਾਰ ਇਸ ਕਾਰਨ ਕਰ ਸਕਦੇ ਹੈ ਜਿ ਜਿਵੇਂ ਕਿਸੇ ਦਾ ਕਰ ਫਰੀ ਟਰੈਕਟਰ ਪ੍ਰੋਵਾਈਡ ਕਰ ਸਕੇ ਹਰ ਕਿਸਾਨ ਨੂੰ ਜਾਂ ਫਿਰ ਸਬਸਿਡੀਜ ਏ ਦੇ ਸ ਦੇ ਸਕੀਏ ਕਿਸਾਨ ਨੂੰ ਤਾਂ ਇਹਦੇ ਨਾਲ ਅਸੀਂ ਪੇਂਡੂ ਇਲਾਕਿਆਂ ਵਿੱਚ ਖੇਤੀਬਾੜੀ ਨੂੰ ਕਾਫੀ ਜ਼ਿਆਦਾ ਸੁਧਾਰ ਦੇ ਸਕਦੇ ਹਨ ਅਤੇ ਜੇ ਸਰਕਾਰ ਇਹ ਸਭ ਕਾਰਜ ਹੋ ਗਈ ਜਾਂ ਸਰਕਾਰ ਕੋਈ ਇਨੀਸ਼ੀਏਟਿਵ ਲਵੇ ਕਿ ਕਿਸਾਨਾਂ ਨੂੰ ਉਹ ਕਰ ਸਕੇ ਬਟ ਕੀ ਸ ਸਰਕਾਰ ਅੱਜ ਕੱਲ੍ਹ ਕਿਸਾਨਾਂ ਦੇ ਵਿਰੁੱਧ ਹੀ ਖੜ੍ਹਦੀ ਹੈ ਕਿਉਂਕਿ ਕਿਸਾਨ ਅੱਜ ਕੱਲ੍ਹ ਐਮ ਐਸ ਪੀ ਦੀ ਮੰਗ ਕਰ ਰਹੇ ਆ ਸਰਕਾਰਾਂ ਤੋਂ ਅਤੇ ਸਰਕਾਰ ਉਹਨੂੰ ਨਹੀਂ ਮੰਨ ਰਹੀ ਮੋਦੀ ਸਰਕਾਰ ਉਹਨੂੰ ਨਹੀਂ ਮੰਨ ਰਹੀ ਤਾਂ ਫਿਰ ਕਿਸਾਨਾਂ ਲਈ ਸਾਡੀ ਸਰਕਾਰ ਇੱਕ ਨੈਗੇਟਿਵ ਇੰਪੈਕਟ ਦੇ ਰਹੀ ਹੈ ਅਤੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਉਹਨਾਂ ਨਾਲ ਬੈਠੋ ਅਤੇ ਕੋਪਰੇਟ ਕਰੋ ਅਤੇ ਉਹਨਾਂ ਨਾਲ ਇੱਕ ਵਾਰੀ ਗੱਲ ਕਰੋ ਅਤੇ ਗੱਲ ਕਰਕੇ ਮਾਮਲਾ ਸੁਟਾਓ ਅਤੇ ਇਹਦੇ ਨਾਲ ਅਸੀਂ ਸੁਧਾਰ ਲਾ ਸਕਦੇ ਹਾਂ ਖੇਤੀਬਾੜੀ ਵਿੱਚ ਬਟ ਪ੍ਰੈਜੈਂਟਲੀ ਸਾਡੇ ਦੇਸ਼ ਵਿੱਚ ਖੇਤੀਬਾੜੀ ਕਾਫੀ ਵਿਗੜੀ ਹੋਈ ਹੈ ਅਤੇ ਕੋਈ ਇਹਦੇ ਇਹਦੇ ਵੱਲ ਧਿਆਨ ਵੀ ਨਹੀਂ ਦੇ ਰਿਹਾ